ਹਾਂਜੀ ਅਸੀਂ ਜੀ ਗਏ ਸੀਗੇ ਹਿਮਾਚਲ ਸਾਈਡ ਉਧਰ ਦਾ ਉੱਧਰ ਦਾ ਨਜਾਰਾ ਹੀ ਇੱਦਾਂ ਦਾ ਹੈ ਕੁਦਰਤੀ ਨਜ਼ਾਰਾ ਠੀਕ ਹੈ ਔਰ ਠੀਕ ਹੈ ਠੰਡੀਆਂ ਹਵਾਵਾਂ ਕੁਦਰਤੀ ਨੈਚਰਲ ਸਾਰਾ ਕੁਛ ਹੈ ਯਾਨੀ ਹਰਿਆਲੀ ਹੈ ਚਾਰੋਂ ਤਰਫ ਤੋਂ ਇੰਨਾ ਵਧੀਆ ਮੌਸਮ ਹੈ ਕਦਰਤੀ ਨਜਾਰਾ ਇਦਾਂ ਲੱਗਦਾ ਜਿਵੇਂ ਕੁਦਰਤ ਦੇ ਬਿਲਕੁਲ ਨਜ਼ਦੀਕ ਆ ਗਏ ਤੁਸੀਂ ਆਪਣੇ ਆਪ ਨੂੰ ਦੇਖ ਰਹੇ ਹੋ ਠੀਕ ਹੈ ਇੰਨਾ ਵਧੀਆ ਮੀਨਸ ਉੱਥੋਂ ਦੇ ਪਹਾੜ ਰਸਤੇ ਉੱਥੋਂ ਦੀਆਂ ਜਗ੍ਹਾਵਾਂ ਘੁੰਮਣ ਵਾਲੀਆਂ ਸਪੇਸ ਬਹੁਤ ਹੀ ਵਧੀਆ ਹੈ ਮੀਨਜ਼ ਇੰਨਾ ਮਜ਼ੇਦਾਰ ਆ ਨਾ ਮੋਸਟਨ ਮਨ ਖੁਸ਼ ਹੋ ਜਾਂਦਾ ਜਾ ਕੇ ਇੰਨੀ ਵਧੀਆ ਹੈ ਹਿਮਾਚਲ ਦੀ ਜੋ ਜਗ੍ਹਾ ਜਾਂ ਤਰਾ ਇੰਨੀ ਵਧੀਆ ਨੈਚੁਰਲ ਹੈ ਸਭ ਕੁਛ ਇੱਥੇ ਠੀਕ ਹੈ ਕੋਈ ਵੀ ਇੱਦਾਂ ਬਨਾਵਟੀ ਨਹੀਂ ਹੈਗਾ ਬਹੁਤ ਹੀ ਵਧੀਆ ਪਸੰਦੀ ਦੀ ਚੀਜ਼ ਇਹ